ਫੀਸ ਦਾ ਢਾਂਚਾ ਇਸ ਕਦਰ ਹੁੰਦਾ ਹੈ ਕਿ ਬੱਚਾ ਕਿਹੜੀ ਕਲਾਸ 'ਚ ਦਾਖਲਾ ਲੈਣਾ ਚਾਹੁੰਦਾ ਹੈ ਜੇਕਰ ਉਹ ਪਹਿਲੀ ਕਕਸ਼ਾ 'ਚ ਜਾਂ ਉਹ ਤੋਂ ਨੀਚੇ ਲੈਣਾ ਚਾਹੁੰਦਾ ਹੈ ਤਾਂ ਫੀਸ ਘੱਟ ਹੁੰਦੀ ਹੈ ਅਤੇ ਜਿਵੇਂ ਜਿਵੇਂ ਉਹ ਉੱਪਰ ਵਧਦਾ ਜਾਂਦਾ ਹੈ ਕਕਸ਼ਾ ਵਿੱਚ ਉਹਦੀ ਫੀਸ ਵੱਧ ਜਾਂਦੀ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਸਕੂਲਾਂ ਵਿੱਚ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਜੇਕਰ ਅਸੀਂ ਸਰਕਾਰੀ ਸਕੂਲ ਨੂੰ ਛੱਡ ਕੇ ਬਾਕੀ ਸਕੂਲਾਂ ਵੱਲ ਧਿਆਨ ਦੇਵਨ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਤਾਂ ਫੀਸ ਘੱਟ ਹੀ ਹੁੰਦੀ ਹੈ ਪਰ ਜਿਵੇਂ ਕਿ ਪ੍ਰਾਈਵੇਟ ਸਕੂਲ ਹੁੰਦੇ ਹਨ ਜੋ ਕਿ ਸਰਕਾਰੀ ਨਹੀਂ ਹੁੰਦੇ ਅਤੇ ਉਹਨਾਂ ਵਿੱਚ ਸ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਨਾਲੇ ਇਹ ਕਈ ਇਹੋ ਜਿਹੇ ਕਈ ਪਰਿਵਾਰ ਹੁੰਦੇ ਹਨ ਜੇ ਕਿ ਫੀਸ ਜੇ ਨਾ ਦੇਣ ਉਹਨਾਂ ਨੂੰ ਫਾਈਨ ਵੀ ਪੈਂਦਾ ਹੈ ਜਿਹੜੀ ਕਿ ਬਹੁਤ ਹੀ ਠੀਕ ਗੱਲ ਨਹੀਂ ਹੈ ਉਹਨਾਂ ਨੂੰ ਸਮੇਂ ਦਿੱਤਾ ਜਾਵੇ ਪੂਰਾ ਜੇਕਰ ਉਹ ਉਸ ਮਹੋਲ 'ਚ ਆਉਂਦੇ ਹਨ ਜਹਾਂ ਜਿੱਥੇ ਉਹ ਫੀਸ ਨਹੀਂ ਭਰ ਸਕਦੇ ਜੇਕਰ ਉਹ ਇੰਨਾ ਨਹੀਂ ਕਮਾ ਸਕਦੇ ਉਹਨਾਂ ਨੂੰ ਸਮੇਂ ਦਿੱਤਾ ਜਾਵੇ ਕਿ ਉਹ ਆਪਣੇ ਬੱਚਿਆਂ ਦੀ ਫੀਸ ਜਮ੍ਹਾ ਕਰਾਉਣ ਨਾ ਕਿ ਉਹਨਾਂ ਤ 'ਚ ਉਹਨਾਂ ਨੂੰ ਫਾਈਨ ਦਿੱਤਾ ਜਾਵੇ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹੋ ਜਿਹੇ ਕਈ ਬੱਚੇ ਹਨ ਜੋ ਕਿ ਪੜ੍ਹਨਾ ਚਾਹੁੰਦੇ ਹਨ ਪਰ ਫੀਸ ਕਾਰਨ ਨਹੀਂ ਪੜ੍ਹ ਸਕਦੇ ਸਾਡੇ ਆਲੇ ਦੁਆਲੇ ਵੀ ਕਈ ਬੱਚੇ ਹਨ ਜਿਹੜਾ ਕਿ ਪੜ੍ਹਨੇ ਚਾਹੁੰਦੇ ਹਨ ਪਰ ਫੀਸ ਹੀ ਇਸ ਕਦਰ ਉੱਚੀ ਹੁੰਦੀ ਹੈ ਕਿ ਉਹ ਪੜ੍ਹਨ ਦਾ ਖ਼ਿਆਲ ਹੀ ਛੱਡ ਦਿੰਦੇ ਹਨ ਇਸੇ ਤਰ੍ਹਾਂ ਸਾਨੂੰ ਫੀਸ ਦਾ ਢਾਂਚਾ ਵੀ ਬਹੁਤ ਹੀ ਸੋਚ ਸਮਝ ਕੇ ਰੱਖਣਾ ਚਾਹੀਦਾ ਹੈ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਦੇ ਮਾਪਿਆਂ ਵੱਲ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਫੀਸ ਦਾ ਢਾਂਚਾ ਠੀਕ ਨਾ ਹੋਣ ਤਾਂ ਇਹ ਬਹੁਤ ਹੀ ਬੁਰਾ ਅਸਰ ਪਾਵੇਗਾ ਸਾਡੀ ਆਉਣ ਵਾਲੀ ਪੀੜ੍ਹੀ ਉੱਤੇ ਕਿਉਂਕਿ ਉਹ ਪੜ੍ਹ ਲਿਖ ਨਹੀਂ ਪਾਉਣਗੀਆਂ ਕਿਉਂਕਿ ਸਕੂਲਾਂ 'ਚ ਫੀਸ ਬਹੁਤ ਹੀ ਜ਼ਿਆਦਾ ਉੱਚੀ ਹੋਵੇਗੀ ਅਤੇ ਮਾਪੇ ਉਹ ਨਹੀਂ ਦੇ ਪਾਉਣਗੇ